ਨਵੇਂ ਜੰਮੇ ਬੱਚੇ ਦੀ ਦੇਖਭਾਲ ਬਹੁਤ ਹੀ ਬਹੁਤ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਕਿਉਂਕਿ ਓਹਨਾਂ ਦੀ ਸਕਿੰਨ ਬਹੁਤ ਨਾਜੁਕ ਹੁੰਦੀ ਹੈ ਅਤੇ ਜਲਦੀ ਹੀ ਬਿਮਾਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਓਹ ਆਪਣਾ ਦਰਦ ਦੱਸ ਵੀ ਨਹੀਂ ਸਕਦੇ ਬੱਚਿਆਂ ਦੇ ਕੱਪੜੇ ਰੋਜ਼ ਬਦਲਣੇ ਚਾਹੀਦੇ ਹਨ ਅਤੇ ਮੌਸਮ ਦੇ ਹਿਸਾਬ ਨਾਲ ਬਦਲਣੇ ਰਹਿਣਾ ਚਾਹੀਦਾ ਹੈ ਨੇਲ ਵੀ ਕੱਟਦੇ ਰਹਿਣਾ ਚਾਹੀਦਾ ਹੈ ਇਸ ਤੋਂ ਬਿਨਾਂ ਲਾ ਇਹ ਲਾਜ਼ਮੀ ਬਣਾਉ ਬਣਾਉਣਾ ਚਾਹੀਦਾ ਹੈ ਕਿ ਓਹਨਾਂ ਨੂੰ ਪਹਿਲੇ ਤਿੰਨ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਪਿਲਾਇਆ ਜਾਵੇ ਕਿਉਂਕਿ ਇਹ ਮੰਨਿਆਂ ਜਾਂਦਾ ਹੈ ਕਿ ਮਾਂ ਦਾ ਦੁੱਧ ਬੱਚੇ ਲਈ ਹੀ ਅੰਮ੍ਰਿਤ ਹੁੰਦਾ ਹੈ